ਜੀ ਹਾਂ ਮੈਂ ਮਾਸਟਰ ਸਲੀਮ ਨੂੰ ਲਾਈਵ ਸੁਣਿਆ ਹੈ ਇੱਕ ਵਾਰ ਮੈਂ ਇੱਕ ਮੇਲੇ ਗਿਆ ਸੀ ਉੱਥੇ ਮਾਸਟਰ ਸਲੀਮ ਆਇਆ ਹੋਇਆ ਸੀ ਮੈਨੂੰ ਉਸਦੀਆਂ ਭੇਟਾਂ ਸੁਣ ਕੇ ਬਹੁਤ ਅੱਛਾ ਲੱਗਿਆ ਉਹ ਮੇਰਾ ਇੱਕ ਫੇਵਰੇਟ ਗਾਇਕ ਵੀ ਹੈ ਉਹ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ ਉਹ ਬਹੁਤ ਸੋਹਣੀਆਂ ਭੇਟਾਂ ਗਾਉਂਦਾ ਹੈ ਉਸਦੀਆਂ ਭੇਟਾਂ ਸੁਣ ਕੇ ਸਾਰੇ ਲੋਕ ਮਨਮੋਹਿਤ ਹੋਏ ਪਏ ਸਨ ਉਹ ਇੱਕ ਪੰਜਾਬ ਦਾ ਮਸ਼ਹੂਰ ਗਾਇਕ ਹੈ ਉਸਨੂੰ ਸਾਰੇ ਲੋਕ ਪਸੰਦ ਕਰਦੇ ਹਨ ਉਹ ਮਾਤਾ ਦੀਆਂ ਭੇਟਾਂ ਬਹੁਤ ਵਧੀਆ ਗਾਉਂਦਾ ਹੈ ਉਹ ਕਵਾਲੀਆਂ ਵੀ ਗਾਉਂਦਾ ਹੈ ਜ਼ਿਆਦਾਤਰ ਉਸਨੂੰ ਹੀ ਮੇਲਿਆ ਵਿੱਚ ਸੱਦਿਆ ਜਾਂਦਾ ਹੈ ਮੈਨੂੰ ਉਸ ਦਾ ਲਾਈਵ ਸ਼ੋ ਦੇਖ ਕੇ ਬਹੁਤ ਵਧੀਆ ਲੱਗਿਆ ਮੈਂ ਉਸ ਨੂੰ ਪਸੰਦ ਸੁਣਨਾ ਇਸ ਕਰਕੇ ਕਰਦਾ ਹਾਂ ਕਿਉਂਕਿ ਉਹ ਇੱਕ ਧਾਰਮਿਕ ਗੀਤ ਜ਼ਿਆਦਾ ਗਾਉਂਦਾ ਹੈ